ਮੇਰੀ ਸੋਚ ਇਹ ਹੈ ਕਿ ਬੁਣਾਈ ਅਤੇ ਸਿਲਾਈ ਨੇ ਮੇਰੇ ਜੀਵਨ ਨੂੰ ਕਾਫੀ ਪ੍ਰਭਾਵਿਤ ਕੀਤਾ ਜਿਵੇਂ ਕਿ ਮੇਰੇ ਘਰ ਦਾ ਖਰਚਾ ਮੈਂ ਖੁਦ ਚਲਾਉਂਦੀ ਹਾਂ ਆਪਦੇ ਕੱਪੜੇ ਤਾਂ ਸਿਉਂਦੀ ਹਾਂ ਲੋਕਾਂ ਦੇ ਕੱਪੜੇ ਵੀ ਸਿਉਂਦੀ ਹਾਂ ਅਤੇ ਮੇਰਾ ਇੱਕ ਸਿਲਾਈ ਸੈਂਟਰ ਵੀ ਹੈ ਉੱਥੇ ਵੀ ਕਾਫੀ ਕੁੜੀਆਂ ਨੂੰ ਸਿਲਾਈ ਸਿਖਾਈ ਜਾਂਦੀ ਹੈ ਜਿੱਥੇ ਕਿ ਲੋੜਵੰਦ ਕੁੜੀਆਂ ਨੇ ਵੀ ਸਿਲਾਈ ਸਿੱਖੀ ਅਤੇ ਅੱਜ ਦੇ ਟਾਈਮ 'ਚ ਉਹ ਆਪਦੇ ਘਰ ਆਪ ਚਲਾਓ ਵੀ ਖਰਚਾ ਘਰ ਦਾ ਆਪ ਕੱਢਦੀਆਂ ਜਿਹਦੇ ਕਰਕੇ ਵੀ ਇੱਦਾਂ ਮੇਰੇ ਪਰਿਵਾਰ ਨੂੰ ਪੂਰਾ ਮਾਣ ਹੈ ਮੇਰੇ 'ਤੇ ਵੀ ਲੋਕਾਂ ਵਾਸਤੇ ਵੀ ਚਲੋ ਕੋਈ ਚੰਗਾ ਕੰਮ ਕੀਤਾ ਹੈ ਵੀ ਫਾਇਦਾ ਹੈ ਲੋਕਾਂ ਨੂੰ ਕੁੜੀਆਂ ਨੂੰ ਇਸ ਚੀਜ਼ ਦਾ ਜਿਵੇਂ ਕਿ ਪਹਿਲਾਂ ਦੇ ਟਾਈਮ ਵਿੱਚ ਤਾਂ ਇਹ ਕੰਮ ਹਰ ਘਰਾਂ 'ਚ ਆਮ ਹੁੰਦਾ ਸੀ ਬੁੜੀਆਂ ਆਪ ਹੀ ਘਰਾਂ 'ਚ ਕਰਦੀਆਂ ਹੁੰਦੀਆਂ ਸੀ ਅੱਜ ਦੇ ਟਾਈਮ ਵਿੱਚ ਇਹ ਕੰਮ ਕੋਈ ਕੋਈ ਕਰਦਾ ਪਹਿਲਾਂ ਇਹ ਕੰਮ ਸ਼ੌਕ ਨੂੰ ਕੀਤਾ ਜਾਂਦਾ ਸੀ ਅਤੇ ਅੱਜ ਹੁਣ ਇੰਨੇ ਮਤਲਬ ਇਹ ਕੰਮ ਘੱਟ ਗਿਆ ਕੰਮ ਕੋਈ ਕੋਈ ਕਰਦਾ ਅਤੇ ਕਰਦਾ ਮਤਲਬ ਕਮਾਈ ਵਾਸਤੇ ਹੈ ਜਿਵੇਂ ਕਿ ਆਪਦੇ ਕੱਪੜੇ ਖੁਦ ਸਿਲਾਈ ਕਰਨੇ ਅਤੇ ਪਹਿਲਾਂ ਜਿਵੇਂ ਲੋਕ ਆਪਦੇ ਘਰਾਂ ਦੇ ਵਿੱਚ ਸਾਰੇ ਕੰਮ ਕਰਦੇ ਸੀ ਕੋਟੀਆਂ ਅਤੇ ਜਾਕਟਾਂ ਬਣਾਉਂਦੇ ਸੀਗੇ ਸੂਟਾਂ 'ਤੇ ਹੈਂਡਵਰਕ ਜਿਵੇਂ ਕਰਦੇ ਸੀ ਰੁਮਾਲ ਬਣਾਉਂਦੇ ਸੀ ਅੱਜ ਦੇ ਟਾਈਮ ਵਿੱਚ ਇਹ ਕਮਾਈ ਦਾ ਹੀ ਜ਼ਰੀਆ ਬਣ ਗਿਆ ਪੈਸਾ ਤਾਂ ਬਹੁਤ ਕਮਾਇਆ ਮੈਂ ਵੀ ਅਤੇ ਕਮਾਈ ਵੀ ਜਾਂਦੀ ਹਾਂ ਪਰ ਇਹਦਾ ਦੁੱਖ ਵੀ ਹੈ ਨੁਕਸਾਨ ਵੀ ਹੈ ਜਿਵੇਂ ਕਿ ਵੀ ਇਹਦੇ ਸਿਲਾਈ ਕਰਨ ਦੇ ਨਾਲ ਨਿਗ੍ਹਾ ਲੱਗਦੀ ਹੈ ਢੂਹੀ ਦੁਖਣ ਲੱਗਦੀ ਲੱਗ ਗਈ ਅਤੇ ਸਰਵਾਈਕਲ ਹੋ ਗਿਆ ਢੂਹੀ ਦੁਖਣ ਦੇ ਨਾਲ ਵੀ ਨੂੰ ਹੈਗਾ ਬੈਠਣ 'ਚ ਦਿੱਕਤ ਹੁੰਦੀ ਹੈ ਨਿਗ੍ਹਾ ਘੱਟ ਗਈ ਨਿ ਚਸ਼ਮਾ ਲੱਗ ਗਿਆ ਚਸ਼ਮਾ ਲੱਗਣ ਦੇ ਨਾਲ ਸਿਰ ਦਰਦ ਵੀ ਹੁੰਦਾ ਨਿਗ੍ਹਾ ਘਟਣ ਦੇ ਨਾਲ ਸਿਰ ਦਰਦ ਵੀ ਹੁੰਦਾ